ਬਹੁਤ ਬਹੁਤ ਧੰਨਵਾਦ ਭਾਅ ਜੀ ਤੁਸੀਂ ਮੈਨੂੰ ਬਹੁਤ ਘੱਟ ਸਮੇਂ ਦੇ ਵਿੱਚ ਮੇਰੀ ਮੰਜ਼ਿਲ 'ਤੇ ਪਹੁੰਚਾ ਤਾ ਪਰ ਮੇਰੀ ਔਨਲਾਈਨ ਪੇਮੈਂਟ 'ਚ ਕੋਈ ਪ੍ਰੋਬਲਮ ਇਸ਼ੂ ਇਸ਼ੂ ਕ੍ਰੀਏਟ ਹੋਣ ਕਰਕੇ ਪੇਮੈਂਟ ਔਨਲਾਈਨ ਹੋ ਨਹੀਂ ਰਹੀ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਮੈਥੋਂ ਪੇਮੈਂਟ ਨਕਦ ਲੈ ਸਕਦੇ ਹੋ